ਦੇ ਜੋ ਬਗੀਚਾ ਲਾਉਣ ਵਾਲਾ ਮਾਲੀ ਵੀਰ ਆਇਆ ਸੀ ਉਸ ਨੇ ਸਾਡੇ ਅਨੁਭਵ ਅਨੁਸਾਰ ਹੀ ਸਾਡਾ ਕੰਮ ਕੀਤਾ ਉਸ ਨੇ ਵਿਚਾਰੇ ਨੇ ਸਾਨੂੰ ਬਹੁਤ ਸਹਾਇਤਾ ਨਾਲ ਕੀਤੀ ਅਸੀਂ ਵੀ ਉਸ ਦੀ ਮਦਦ ਕੀਤੀ ਬਗੀਚਾ ਉਸ ਨੇ ਹਰੇਕ ਇੱਕ ਬੂਟਾ ਪੌਦਾ ਸੇਮ ਲਾਈਨ ਵਿੱਚ ਲਗਾਇਆ ਉਸ ਨੂੰ ਅਸੀਂ ਜੋ ਦੱਸਦੇ ਗਏ ਉਹ ਉਸੀ ਤਰ੍ਹਾਂ ਕਰਦਾ ਗਿਆ ਅਸੀਂ ਵੀਹ ਪੌਦੇ ਇੱਕ ਲਾਈਨ ਵਿੱਚ ਲਾਏ ਅਤੇ ਵੀਹ ਪੌਦੇ ਦੂਸਰੀ ਲਾਈਨ ਵਿੱਚ ਲਾਏ ਇਸ ਨਾਲ ਬਗੀਚੇ ਦੀ ਚਕਾਚੋਂਦ ਬਹੁਤ ਹੋ ਗਈ ਬਹੁਤ ਸੋਹਣਾ ਬਗੀਚਾ ਲਾਇਆ ਮਾਲੀ ਵੀਰ ਨੇ ਅਸੀਂ ਉਸਦੇ ਬਹੁਤ ਧੰਨਵਾਦੀ ਹਾਂ ਹਰੇਕ ਨੂੰ ਆਪਣਾ ਬਗੀਚਾ ਲਾਉਣਾ ਚਾਹੀਦਾ ਬਗੀਚਾ ਲਗਾਉਣ ਨਾਲ ਆਲੇ ਵਾਤਾਵਰਨ ਸਾਫ ਸੁਥਰਾ ਰਹਿੰਦਾ ਹੈ ਅਤੇ ਆਪਾਂ ਨੂੰ ਨਿੱਤ ਨਵੀਂ ਨਵੀਂ ਆਕਸੀਜਨ ਮਿਲਦੀ ਰਹਿੰਦੀ ਹੈ ਬਗੀਚਾ ਲਗਾਉਣ ਨਾਲ ਸਾਨੂੰ ਬਹੁਤ ਲਾਭ ਹੋਏ